ਹੈਲੋ ਹਾਂਜੀ ਵੀਰ ਜੀ ਸ਼ਰਮਾ ਸਟੂਡੀਓ ਤੋਂ ਬੋਲਦੇ ਹੋ ਜੀ ਅੱਛਾ ਕੀ ਹਾਲ ਚਾਲ ਨੇ ਠੀਕ ਹੋ ਵੀਰੇ ਅੱਛਾ ਨਾ ਇੱਕ ਨਾ ਆਪਣੇ ਯਾਰ ਵਿਆਹ ਗਾ ਮਤਲਬ ਅਤੇ ਉਸਦੇ ਲਈ ਵੀ ਬੁੱਕ ਕਰਨਾ ਸੀਗਾ ਤੁਹਾਨੂੰ ਹਾਂਜੀ ਅਤੇ ਆਪਣੇ ਇੱਕ ਜਨਵਰੀ ਦੋ ਹਜ਼ਾਰ ਪੱਚੀ ਦਾ ਵਿਆਹ ਗਾ ਜੀ ਹਾਂਜੀ ਹਾਂਜੀ ਤੁਹਾਡੀ ਡੇਟ ਮਤਲਬ ਵਿਹਲੀ ਆ ਜੀ ਇਹ ਕੰਮ ਤਾਂ ਹੈ ਆ ਜੀ ਇੱਕ ਦਿਨ ਤਾਂ ਜਾਗੋ ਦਾ ਹੋ ਜਾਵੇਗਾ ਜੀ ਪ੍ਰੋਗਰਾਮ ਇੱਕ ਦਿਨ ਤਾਂ ਨਹੀਂ ਇੱਕ ਦਿਨ ਜਾਗੋ ਆ ਗਈ ਅਗਲੇ ਦਿਨ ਮਤਲਬ ਮੈਰਿਜ ਬਰਾਤ ਦਾ ਗਾ ਜਾਗੋ ਦਾ ਹੈਗਾ ਜੀ ਇਕੱਤੀ ਦਸੰਬਰ ਦਾ ਅਤੇ ਇੱਕ ਤਰੀਕ ਦੀ ਮਤਲਬ ਬਰਾਤ ਆਵੇਗੀ ਹਾਂਜੀ ਕੀ ਤੁਸੀਂ ਫਰੀ ਹੋਊਗੇ ਜੀ ਇਸ ਡੇਟ ਨੂੰ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਅਤੇ ਮਤਲਬ ਕਿਵੇਂ ਕੀ ਹਿਸਾਬ ਕਿਤਾਬ ਲੈਂਦੇ ਹੋ ਤੁਸੀਂ ਫੋਟੋ ਦਾ ਅਤੇ ਵੀਡੀਓ ਦਾ ਹਾਂਜੀ ਹਾਂ ਅੱਛਾ ਜੀ ਅੱਛਾ ਜੀ ਇੱਕ ਨਾ ਜੀ ਤੁਹਾਡੀ ਥੋੜ੍ਹੀ ਜੀ ਇੱਕ ਨਾ ਜੀ ਤੁਹਾਡੀ ਥੋੜ੍ਹੀ ਜਿਹੀ ਆਵਾਜ਼ ਨਾ ਸਾਫ ਨਹੀਂ ਆ ਰਹੀ ਹਾਂਜੀ ਹਾਂਜੀ ਹੁਣ ਹੁਣ ਹੁਣ ਸਾਫ ਆਉਂਦੀ ਹਾਂਜੀ ਹਾਂਜੀ ਹਾਂਜੀ ਵਧੀਆ ਹਾਂਜੀ ਅੱਛਾ ਜੀ

ਹਾਂਜੀ ਅੱਛਾ ਜੀ ਅੱਛਾ ਜੀ ਹਾਂ ਹਾਂਜੀ ਅੱਛਾ ਜੀ ਅੱਛਾ ਮੈਂ ਕਹਾਂ ਅੱਛਾ ਜੀ ਮਤਲਬ ਇਹ ਓਵਰਆਲ ਤੁਸੀਂ ਮੈਰਿਜ ਦਾ ਹੁੰਦਾ ਤੁਹਾਡਾ ਉੱਕਾ ਪੁੱਕਾ ਹਾਂ ਹਾਂਜੀ ਹਾਂ ਮਤਲਬ ਹਾਂਜੀ ਹਾਂ ਜੀ ਹਾਂ ਬਾਕੀ ਉਹ ਤੁਹਾਡਾ ਮਤਲਬ ਜਿਹੋ ਜੀ ਐਲਬਮ ਦਾ ਪੇਪਰ ਲਵਾਉਣਾ ਬਾਕੀ ਐਕਸਟਰਾ ਉਹ ਆ ਜਾਂਦਾ ਗਾ ਅੱਛਾ ਜੀ ਅੱਛਾ ਹਾਂਜੀ ਅਤੇ ਮਤਲਬ ਇੱਕ ਆਪਣਾ ਹੁੰਦਾ ਆ ਅਤੇ ਪ੍ਰੀ ਵੈਡਿੰਗ ਦਾ ਵੀ ਇਹਦੇ ਵਿੱਚ ਹੀ ਹੁੰਦਾ ਗਾ ਜੀ ਮਤਲਬ ਤੁਹਾਡਾ ਅੱਛਾ ਜੀ ਉਹਦਾ ਐਕਸਟਰਾ ਹੁੰਦਾ ਗਾ ਜੀ ਪੈਸਾ ਅੱਛਾ ਜੀ ਇਹਦੀ ਮਤਲਬ ਜਿਹੜੀ ਤੁਸੀਂ ਲੋਕੇਸ਼ਨ ਵਗੈਰਾ ਹੁੰਦੀ ਹੈ ਇਹ ਕਿੱਥੋਂ ਤੁਹਾਡੀ ਹੁੰਦੀ ਹੈ ਜਾਂ ਉਹ ਹੁੰਦੀ ਹੈਗੀ ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਜੀ ਅੱਛਾ ਅਤੇ

ਆਮ ਮਤਲਬ ਆਪਣਾ ਤਾਂ ਇਹੀ ਸੀ ਕਿ ਸਾਡਾ ਵੀ ਮਤਲਬ ਪੇਂਡੂ ਕਲਚਰ ਜਾਂ ਕੋਈ ਪੇਂਡੂ ਜੀ ਲੋਕੇਸ਼ਨ ਹੋਵੇ ਜੀ ਕੋਈ ਜਿਵੇਂ ਪੁਰਾਣੇ ਘਰਾਂ ਦੀ ਲੋਕੇਸ਼ਨ ਹੁੰਦੀ ਹੈ ਨਾ ਆਪਣੀ ਇੱਦਾਂ ਦੀ ਕੋਈ ਲੋਕੇਸ਼ਨ ਹੋਵੇ ਹਾਂ ਜੀ ਹਾਂ ਅਤੇ ਹਾਂਜੀ ਅੱਛਾ ਜੀ ਅੱਛਾ ਜੀ ਅੱਛਾ ਅੱਛਾ ਜੀ ਅੱਛਾ ਅੱਛਾ ਅੱਛਾ ਜੀ ਅੱਛਾ ਮਤਲਬ ਇਹਦੀ ਅਲੱਗ ਹੁੰਦੀ ਹੈ ਚਲੋ ਕੋਈ ਗੱਲ ਨਹੀਂ ਜੀ ਅਸੀਂ ਆਪਣੇ ਗੁਆਂਢ 'ਚੋਂ ਲੈਤਾ ਸੀਗਾ ਨੰਬਰ ਅਤੇ ਉਹਨਾਂ ਦਾ ਕੰਮ ਤੁਹਾਡਾ ਕੰਮ ਬਹੁਤ ਸਾਨੂੰ ਪਸੰਦ ਆਇਆ ਸੀਗਾ ਵਧੀਆ ਸੀਗਾ ਤੁਹਾਡਾ ਕੰਮ ਅੱਛਾ ਜੀ ਹਾਂਜੀ ਹਾਂ ਠੀਕ ਹੈ ਜੀ ਅੱਛਾ ਜੀ ਅੱਛਾ ਅੱਛਾ ਨਹੀਂ ਅਸੀਂ ਵੈਸੇ ਤੁਹਾਡੇ ਕੰਮ ਦੇਖਿਆ ਸੀਗਾ ਜੀ ਤੁਹਾਡਾ ਕੰਮ ਬਹੁਤ ਵਧੀਆ ਸੀਗਾ ਅਤੇ ਇਸੇ ਕਰਕੇ ਅਸੀਂ ਨੰਬਰ ਲਿੱਤਾ ਜੀ ਤੁਹਾਡੇ ਨਾਲ ਕੋਂਟੈਕਟ ਕੀਤਾ ਗਾ ਅਤੇ ਬਾਕੀ ਅਸੀਂ ਫੇਰ ਆਵਾਂਗੇ ਜੀ ਤੁਹਾਡੇ ਨਾਲ ਤਾਂ ਸਾਈ ਦੇ ਜਾਂਗੇ ਬੁੱਕ ਕਰ ਜਾਂਗੇ ਅਤੇ ਇੱਕ ਦੋ ਦਿਨਾਂ ਤੱਕ ਅਸੀਂ ਟਾਈਮ ਕੱਢ ਕੇ ਤੁਹਾਡੇ ਦੁਕਾਨ ਦੇ ਮਿਲਦੇ ਹਾਂ ਜੀ ਤੁਹਾਨੂੰ ਔਫਿਸ ਦੇ ਵਿੱਚ

ਅੱਛਾ ਜੀ ਵੱਡਾ

ਅੱਛਾ ਜੀ ਅੱਛਾ ਜੀ ਅੱਛਾ ਜੀ ਅੱਛਾ ਚਲੋ ਚਲੋ ਕੋਈ ਗੱਲ ਨਹੀਂ ਵੀਰ ਜੀ ਅਸੀਂ ਫੇਰ ਮਿਲਦੇ ਹਾਂ ਤੁਹਾਨੂੰ ਇੱਕ ਦੋ ਦਿਨਾਂ ਦੇ ਠੀਕ ਚਲੋ ਚਲੋ ਠੀਕ ਹੈ ਵੀਰ ਜੀ ਓਕੇ ਓਕੇ ਓਕੇ ਵੀਰ ਜੀ